ਬਾਗਬਾਨੀ ਸ਼ੁਰੂ ਕਰਨ ਲਈ ਸਾਨੂੰ ਸਾਡੇ ਬਜ਼ੁਰਗਾਂ ਤੋਂ ਹੀ ਪ੍ਰੇਰਿਤ ਹੋਏ ਹਾਂ ਹੋਏ ਹਾਂ ਕਿਉਂਕਿ ਅਸੀਂ ਛੋਟੇ ਹੁੰਦੇ ਤੋਂ ਹੀ ਦੇਖਦੇ ਹਾਂ ਸਾਡੇ ਬਜ਼ੁਰਗ ਖੇਤੀ ਕਰਦੇ ਨੇ ਉਹਨਾਂ ਨੇ ਹੀ ਸਾਨੂੰ ਨਾਲ ਲੈ ਜਾਣਾ ਖੇਤ ਉਹਨਾਂ ਨੂੰ ਕੰਮ ਕਰਦਿਆਂ ਨੂੰ ਦੇਖਣਾ ਅਸੀਂ ਵੀ ਕਿਸ ਤਰ੍ਹਾਂ ਉਹ ਫਸਲ ਨੂੰ ਉਗਾਉਂਦੇ ਨੇ ਕਿਸ ਤਰ੍ਹਾਂ ਰੇਹ ਸਪਰੇਅ ਪਾਉਂਦੇ ਨੇ ਉਸੇ ਲੜੀ ਦੇ ਤਹਿਤ ਅਸੀਂ ਖੇਤਾਂ ਵਿੱਚ ਜਾ ਜਾ ਕੇ ਇਸ ਕੰਮ ਨੂੰ ਸਿੱਖ ਲਿਆ ਬਾਗਬਾਨੀ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਆਪਾਂ ਨੂੰ ਫਸਲੀ ਚੱਕਰ 'ਚੋਂ ਵੀ ਕੱਢਦੀ ਹੈ ਜਿਵੇਂ ਕਣਕ ਜੀਰੀ ਇਹ ਚੀਜ਼ਾਂ 'ਚੋਂ ਨਿਕਲਣ ਲਈ ਸਾਨੂੰ ਬਾਗਬਾਨੀ ਕਰਨੀ ਪੈਣੀ ਹੈ ਬਾਗਬਾਨੀ ਨਾਲ ਸਾਨੂੰ ਜਿੱਥੇ ਆਪਦੀ ਸਿਹਤ ਵਾਸਤੇ ਵਧੀਆ ਘਰ ਨੂੰ ਖਾਣ ਲਈ ਆਪਦੇ ਵਾਰੀ ਫਲ ਮਿਲਦਾ ਹੈ ਉੱਥੇ ਅਸੀਂ ਇਸਨੂੰ ਵੇਚ ਕੇ ਕਿੰਨੂ ਵੇਚ ਕੇ ਅਸੀਂ ਆਪਦੇ ਘਰ ਨੂੰ ਮੁਨਾਫਾ ਵੀ ਕਰ ਸਕਦੇ ਹਾਂ ਬਾਗਬਾਨੀ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਇੱਕ ਪ੍ਰੋਫੈਸ਼ਨਲ ਕੰਮ ਹੈ ਬਾਗਬਾਨੀ ਨਾਲ ਸਾਡੇ ਏਰੀਏ ਨੂੰ ਵੀ ਬਹੁਤ ਸਹੂਲਤ ਮਿਲਦੀ ਹੈ ਬਾਗਬਾਨੀ ਸ਼ੁਰੂ ਤੋਂ ਹੀ ਸਾਡੇ ਬਜ਼ੁਰਗਾਂ ਨੇ ਖੇਤੀ ਦੇ ਨਾਲ ਨਾਲ ਇਸ ਚੀਜ਼ ਨੂੰ ਬਹੁਤ ਸਹਾਇਕ ਧੰਦਾ ਬਣਾਇਆ ਹੈ ਬਾਗਬਾਨੀ 'ਚ ਜ਼ਿਆਦਾਤਰ ਸਾਡੇ ਕਿੰਨੂ ਅੰਗੂਰ ਅਮਰੂਦ ਜਾਮਣਾਂ ਇਸ ਚੀਜ਼ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਕਿਉਂਕਿ ਸਾਡੀ ਉਪਜਾਊ ਧਰਤੀ ਇਹ ਚੀਜ਼ਾਂ ਨੂੰ ਬਹੁਤ ਹੀ ਮੰਨਦੀ ਹੈ ਇਸ ਨਾਲ ਸਾਡੇ ਪਰਿਵਾਰ ਦਾ ਵਧੀਆ ਰੁਜ਼ਗਾਰ ਆ ਚੱਲਦਾ ਹੈ ਅਤੇ ਜੋ ਵੀ ਲੋਕ ਸਾਡੇ ਬੱਚੇ ਅੱਜ ਕੱਲ੍ਹ ਪੜ੍ਹਦੇ ਨੇ ਅਤੇ ਨਾਲ ਨਾਲ ਖੇਤੀ ਦੇ ਵੀ ਸਹਾਇਕ ਧੰਦੇ ਕਰਦੇ ਨੇ ਬਾਗਬਾਨੀ ਦਾ ਹੋਇਆ ਇਸ ਚੀਜ਼ ਦਾ ਬਾਗਬਾਨੀ ਇੱਕ ਅਜਿਹੀ ਚੀਜ਼ ਹੈ ਜੋ ਕਿ ਸਾਨੂੰ ਹਰ ਇੱਕ ਨੂੰ ਫਸਲੀ ਚੱਕਰ 'ਚੋਂ ਨਿਕਲ ਕੇ ਇੱਕ ਇੱਕ ਦੋ ਦੋ ਕਿੱਲੇ ਕੋਈ ਅੱਧਾ ਕਿੱਲਾ ਕੋਈ ਇੱਕ ਕਨਾਲ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਵੀ ਇਸ ਚੀਜ਼ 'ਤੇ ਬਹੁਤ ਜ਼ੋਰ ਲਾਉਂਦੀਆਂ ਹਨ ਵੀ ਬਾਗਬਾਨੀ ਕਰੋ ਕਿਉਂ ਹੁਣ ਅੱਜ ਕੱਲ੍ਹ ਦਾ ਬੱਚਾ ਪੜ੍ਹਿਆ ਲਿਖਿਆ ਇਸ ਚੀਜ਼ ਵੱਲ ਜਾ ਰਿਹਾ ਹੈ ਅੱਜ ਕੱਲ੍ਹ ਫੁਹਾਰਾ ਸਿਸਟਮ ਸਰਕਾਰਾਂ ਇਸ ਚੀਜ਼ 'ਤੇ ਦਿੰਦੀਆਂ ਨੇ ਜੋ ਕਿ ਬਾਗਬਾਨੀ ਨੂੰ ਬਹੁਤ ਹੀ ਉਤਸ਼ਾਹਿਤ ਕਰਦਾ ਹੈ ਅਤੇ ਸਰਕਾਰਾਂ ਨੇ ਹੁਣ ਹਰ ਇੱਕ ਮੰਡੀ ਅਤੇ ਚੀਜ਼ ਫਲ ਖਰੀਦਣਾ ਇਸ ਚੀਜ਼ ਨੂੰ ਪਹਿਲ ਦਿੱਤੀ ਹੈ ਬਾਗਬਾਨੀ ਇੱਕ ਬਹੁਤ ਵਧੀਆ ਕਿੱਤਾ ਹੈ ਨੌਕਰੀ ਦੇ ਨਾਲ ਨਾਲ ਵਿੱਚ ਸਾਡੇ ਬੱਚੇ ਇਸ ਤਰ੍ਹਾਂ ਨੇ ਜੋ ਖੇਤ ਜਾ ਕੇ ਬਾਗਬਾਨੀ ਵੀ ਕਰਦੇ ਹਨ ਧੰਨਵਾਦ